ਮੈਂ ਜ਼ਿਆਦਾਤਰ ਕਿਤਾਬਾਂ ਗਰੀਸੀਅਸ ਬੁੱਕ ਸਟੋਰ ਤੋਂ ਜਾਂ ਬੁੱਕਾ ਬੂਟਾ ਬੁੱਕ ਸੈਂਟਰ ਤੋਂ ਜਾਂ ਅਲੱਗ ਅਲੱਗ ਪਬਲਿਸ਼ਰਾਂ ਤੋਂ ਮੰਗਵਾਉਂਦੀ ਹੈਗੀ ਜਾਂ ਜਿਵੇਂ ਯੂਨੀਵਰਸਿਟੀ ਦੇ ਵਿੱਚ ਜਾਂ ਅਲੱਗ ਅਲੱਗ ਜਗ੍ਹਾ 'ਤੇ ਕੋਈ ਬੁੱਕ ਫੇਅਰ ਲੱਗਦਾ ਹੈਗਾ ਤਾਂ ਉੱਥੋਂ ਜਾ ਕੇ ਬੁੱਕਸ ਖਰੀਦ ਲੈਂਦੀ ਹਾਂ ਜਾਂ ਪਟਿਆਲਾ ਦੇ ਵਿੱਚ ਇੱਕ ਬੁੱਕ ਮਾਰਕਿਟ ਆ ਗਈ ਬੁੱਕ ਮਾਰਕਿਟ ਦੇ ਨਾਮ ਦੇ ਨਾਲ਼ ਫੇਮਸ ਹੈਗੀ ਤਾਂ ਉੱਥੋਂ ਵੀ ਖਰੀਦੀਆਂ ਜਾਂਦੀਆਂ ਨੇ ਅਤੇ ਸਸਤੀਆਂ ਅਤੇ ਸੈਕਿੰਡ ਹੈਂਡ ਕਿਤਾਬਾਂ ਦੇ ਲਈ ਇੱਕ ਯੂਨੀਵਰਸਿਟੀ ਦੇ ਬਾਹਰ ਯੂਨੀਵਰਸਲ ਬੁੱਕ ਸਟੋਰ ਹੈ ਤਾਂ ਉਹ ਸੈਕਿੰਡ ਹੈਂਡ ਕਿਤਾਬਾਂ ਵੀ ਦਿੰਦੇ ਹੈਗੇ ਅਤੇ ਉਹਨਾਂ ਕੋਲ ਕਾਫ਼ੀ ਸਸਤੀਆਂ ਵੀ ਕਿਤਾਬਾਂ ਮਿਲ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ਼ ਬੁੱਕ ਮਾਰਕਿਟ ਆ ਪਟਿਆਲੇ ਦੇ ਵਿੱਚ ਉੱਥੋਂ ਵੀ ਜਿਹੜੀਆਂ ਸਸ ਕਿਤਾਬਾਂ ਨੇ ਜਿਹੜੀਆਂ ਸਸਤੀਆਂ ਮਿਲ ਜਾਂਦੀਆਂ ਨੇ ਸੈਕਿੰਡ ਹੈਂਡ ਵੀ ਮਿਲ ਜਾਂਦੀਆਂ ਨੇ ਅਤੇ ਐਵੇਂ ਮੈਂ ਅਲੱਗ ਅਲੱਗ ਜਗ੍ਹਾ ਤੋਂ ਜਿਹੜੀਆਂ ਕਿਤਾਬਾਂ ਹੈਗੀ ਉਹ ਖਰੀਦਦੀ ਰਹਿੰਦੀ ਹੈਗੀ ਅਤੇ ਅਲੱਗ ਅਲੱਗ ਪਬਲਿਸ਼ਰਾਂ ਤੋਂ ਮੈਨੂੰ ਸਸਤੇ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਮਿਲ ਜਾਂਦੀਆਂ ਨੇ